ਗੀਤ ਗਾਉਂਦੇ ਗਾਉਂਦੇ ਸਾਹ ਚੜ੍ਹਨਾ ਜਾਂ ਤਾਹਨੂੰ ਕਾਫ਼ੀ ਦਿੱਕਤ ਆਉਣੀ ਇਸ ਕਰਕੇ ਅੱਜ ਕੱਲ੍ਹ ਦੇ ਲੋਕ ਸੋਚਦੇ ਹਨ ਕਿ ਉਹ ਗਾ ਨਹੀਂ ਸਕਦੇ ਇਹ ਚੀਨਹੀਂ ਨਹੀਂ ਹੁੰਦੀਆਂ ਉਹਨਾਂ ਨੂੰ ਸਾਹ ਚੜ੍ਹ ਜਾਂਦਾ ਗਾਣਾ ਗਾਉਂਦੇ ਗਾਉਂਦੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਰਿਆਂ ਨੂੰ ਸਾਹ ਚੜ੍ਹਦਾ ਹੀ ਚੜ੍ਹਦਾ ਗਾਣੇ ਗਾਉਂਦੇ ਗਾਉਂਦੇ ਪਰ ਉਹ ਆਪਣਾ ਸਾਹ ਇੱਕ ਹੱਦ ਤੱਕ ਰੋਕ ਲੈਂਦੇ ਹਨ ਕਿਉਂਕਿ ਉਹਨਾਂ ਨੇ ਅਭਿਆਸ ਕੀਤਾ ਹੁੰਦਾ ਜਿੱਦਾਂ ਆਪਾਂ ਪੁਰਾਣੇ ਟੈਮ 'ਚ ਅੱਜ ਦੇ ਟੈਮ 'ਚ ਲੋਕ ਜਿਹੜੇ ਅੰਤਰਾਣੇ ਜਿੱਦਾਂ ਸਾ ਰੇ ਗਾ ਮਾ ਦਾ ਅਭਿਆਸ ਕਰਦੇ ਹਨ ਉਹਨਾਂ ਨੇ ਤੁਹਾਡਾ ਜਿਹੜਾ ਸਾਹ ਹੈ ਪੱਕਾ ਹੁੰਦਾ ਤੁਹਾਡੀ ਆਵਾਜ਼ ਨਾ ਕਾਫ਼ੀ ਹੱਦ ਤੱਕ ਤੁਹਾਡੀ ਸੈੱਟ ਹੋ ਜਾਂਦੀ ਅਤੇ ਤੁਹਾਨੂੰ ਸਾਹ ਘੱਟ ਚੜ੍ਹਦਾ ਅੱਜ ਦੇ ਟੈਮ ਵਿੱਚ ਲੋਕਾਂ ਨੂੰ ਉਹ ਚੀਜ਼ ਦਾ ਰਿਆਜ਼ ਕਰਨਾ ਚਾਹੀਦਾ ਜਿਸ ਕਰਕੇ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਘੱਟ ਹੋਵੇਗੀ ਸਾਹ ਉਹਨਾਂ ਨੂੰ ਘੱਟ ਚੜ੍ਹੇਗਾ ਗਾਣਾ ਬੋਲਦੇ ਬੋਲਦੇ ਸਾਹ ਤਾਂ ਚੜ੍ਹਦਾ ਹੀ ਚੜ੍ਹਦਾ ਇੱਕ ਹੱਦ ਤੱਕ ਤੁਸੀਂ ਇੰਨਾ ਲੰਬਾ ਵੀ ਨਹੀਂ ਬੋਲ ਸਕਦੇ ਗਾਣਾ ਸਾਹ ਤੁਹਾਨੂੰ ਚੜ੍ਹਨਾ ਹੀ ਚੜ੍ਹਨਾ ਪਰ ਉਹ ਤੁਹਾਡਾ ਇੱਕ ਰੁਕ ਜਾਂਦਾ ਕਿ ਪੀ ਜ਼ਿਆਦਾ ਗਾਣਾ ਬੋਲ ਸਕੋਗੇ ਇਸ ਕਰਕੇ ਸਾ ਰੇ ਗਾ ਮਾ ਜਿੱਦਾਂ ਆਪਾਂ ਸਾ ਦਾ ਰਿਆਜ਼ ਕਰਦੇ ਹਾਂ ਰੇ ਦਾ ਰਿਆਜ਼ ਕਰਦੇ ਹਾਂ ਉਹ ਸ਼ਬ ਇਹ ਲਾਈਨ ਚੀਜ਼ਾਂ ਬਣੀਆਂ ਇਸ ਕਰਕੇ ਕਿ ਤੁਹਾਡਾ ਜਿਹੜਾ ਇੱਕ ਵੋਕਲ ਹੈ ਤੁਹਾਡੀ ਸਹੀ ਹੋਵੇ ਤੁਹਾਨੂੰ ਸਾਹ ਨਾ ਚੜ੍ਹੇ ਤੁਹਾਨੂੰ ਤੁਸੀਂ ਗਾਣਾ ਅੱਛੀ ਤਰ੍ਹਾਂ ਬੋਲ ਪਾਓ ਤੁਸੀਂ ਵਿੱਚ ਰੁਕਣਾ ਬਹੁ ਜਿੱਦਾਂ ਲੋਕ ਕਈ ਅੜ ਜਾਂਦੇ ਹਨ ਉਹਨਾਂ ਗਲੇ 'ਚ ਖਰਾਸ਼ ਜਿਹੀ ਚੀਜ਼ਾਂ ਹੁੰਦੀਆਂ ਹਨ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਇਹ ਚੀਜ਼ਾਂ ਕਰਕੇ ਇਸ ਕਰਕੇ ਸਾਨੂੰ ਰੋਜ਼ ਸਵੇਰੇ ਉੱਠ ਕੇ ਜਿੱਦਾਂ ਹੁਣ ਮੈਂ ਵੀ ਕਿਸੇ ਟੈਮ ਗਾਣਾ ਬੋਲਦਾ ਤਾਂ ਮੈਨੂੰ ਵੀ ਸਾਹ ਚੜ੍ਹ ਜਾਂਦਾ ਪਰ ਮੈਂ ਸਵੇਰੇ ਸਵੇਰੇ ਰਿਆਜ਼ ਕਰਦਾ ਹਾਂ ਸਵੇਰੇ ਸਵੇਰੇ ਸਾ ਰੇ ਗਾ ਮਾ ਦਾ ਰਿਆਜ਼ ਕਿਉਂਕਿ ਸਵੇਰ ਦੇ ਟੈਮ 'ਤੇ ਅਗਰ ਤੁਸੀਂ ਰਿਆਜ਼ ਕਰਦੇ ਹੋ ਤਾਂ ਤੁਹਾਨੂੰ ਇੱਕ ਤੁਹਾਨੂੰ ਇੱਕ ਸ਼ੁੱਧ ਹਵਾ ਮਿਲਦੀ ਆ ਅਤੇ ਤੁਸੀਂ ਇੱਕ ਫਰੈਸ਼ ਹੁੰਦੇ ਹੋ ਸਵੇਰੇ ਸਵੇਰੇ ਸਵੇਰੇ ਸਵੇਰੇ ਜਦੋਂ ਆਪਾਂ ਗਾਣਾ ਬੋਲਦੇ ਹਾਂ ਆਪਾਂ ਫਰੈਸ਼ ਹੁੰਦੇ ਹਾਂ ਥੋੜ੍ਹਾ ਫਰੈਸ਼ ਹੋ ਕੇ ਗਾਣਾ ਬੋਲਦੇ ਹਨ ਤਾਹਡੇ ਆਵਾਜ਼ ਹੋਰ ਅੱਛੀ ਨਿਕਲਦੀ ਹੈ ਅਤੇ ਆਪਾਂ ਜਦੋਂ ਰਿਆਜ਼ ਕਰਦੇ ਹਨ ਤਾਂ ਆਵਾਜ਼ ਸਾਡੀ ਵੈਸੇ ਅੱਛੀ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਸਵੇਰੇ ਸਵੇਰੇ ਰਿਆਜ਼ ਕਰਨਾ ਚਾਹੀਦਾ